ਪੰਜਾਬੀ ਭਾਸ਼ਾ ਨੂੰ ਲੈ ਕੇ ਮੇਰਾ ਇਹ ਵਿਚਾਰਧਾਰਾ ਹੈ ਕਿ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਪਿਆਰੀ ਭਾਸ਼ਾ ਹੈ ਇਸ ਨੂੰ ਉਰਦੂ ਦੇ ਪਾਸਿਓਂ ਵੀ ਦੇਖ ਸਕਦੇ ਹੈ ਕਿਉਂਕਿ ਉਰਦੂ ਦੇ ਵਿੱਚ ਜ਼ਿਆਦਾਤਰ ਅਲਫਾਜ਼ ਜੋ ਹੈ ਉਹ ਪੰਜਾਬੀ ਦੇ ਹੀ ਵਰਤੇ ਜਾਂਦੇ ਹੈ ਅਤੇ ਗੁਰਮੁਖੀ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਇਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖਿਆ ਗਿਆ ਹੈ ਅਤੇ ਬਹੁਤ ਹੀ ਸੋਹਣੀ ਭਾਸ਼ਾ ਹੈ ਮਾਲਵੇ ਦੀ ਭਾਸ਼ਾ ਅਤੇ ਦੁਆਬੇ ਦੀ ਭਾਸ਼ਾ ਅਤੇ ਮਾਝੇ ਦੀ ਭਾਸ਼ਾ 'ਚ ਫਰਕ ਬਹੁਤ ਹੈ ਕਾਫੀ ਫਰਕ ਪੈ ਜਾਂਦਾ ਹੈ ਪਰ ਤਕਰੀਬਨ ਇਸ ਨੂੰ ਪਿਆਰ ਨਾਲ ਦੀ ਧਾਰਨਾ ਰਾਹੀਂ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਖੂਬਸੂਰਤ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਗਲਤ ਧਾਰਨਾਵਾਂ ਇਹ ਹਨ ਕਿ ਪੰਜਾਬੀਆਂ ਨੂੰ ਖਾਲਿਸਤਾਨੀ ਸਮਝਿਆ ਜਾਂਦਾ ਹੈ ਅਤੇ ਆਮ ਸਿਟੀਆਂ ਦੇ ਵਿੱਚ ਜਦੋਂ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਖਾਲਿਸਤਾਨ ਨੂੰ ਪ੍ਰਮੋਟ ਕਰ ਰਿਹਾ ਬਲਕਿ ਇਹ ਕਦੇ ਵੀ ਨਹੀਂ ਹੈ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਵਾਸਤੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿਹਾ ਜਾਵੇ ਕਿ ਪੰਜਾਬੀ ਲਾਜਮੀ ਰੱਖੋ ਹਰ ਚੁਰਾਹੇ 'ਤੇ ਹਰ ਮੋੜ ਦੇ ਉੱਤੇ ਪੰਜਾਬੀ ਭਾਸ਼ਾ ਦੀ ਲਿਖਤ ਹੋਣੀ ਚਾਹੀਦੀ ਹੈ ਜਿਵੇਂ ਕਿ ਜਿਵੇਂ ਹੀ ਅਸੀਂ ਡੱਬਵਾਲੀ ਜਾਂਦੇ ਹਾਂ ਹਰਿਆਣਾ ਜਾਂਦੇ ਹਾਂ ਉੱਥੇ ਉਸ ਦੇ ਅੰਦ ਉਸ ਸਿਟੀਆਂ ਦੇ ਅੰਦਰ ਜਾ ਜਾਂਦੇ ਹੀ ਹਿੰਦੀ ਸ਼ੁਰੂ ਹੋ ਜਾਂਦੀ ਹੈ ਉੱਥੇ ਉਹਨਾਂ ਵੀ ਜਗ੍ਹਾਵਾਂ 'ਤੇ ਫੇਰ ਪੰਜਾਬੀ ਦੀ ਲੈਂਗੁਏਜ ਲਿਖੀ ਜਾਵੇ ਸੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਭਾਸ਼ਾ ਸਿਖਾਉਣੀ ਚਾਹੀਦੀ ਹੈ ਠੀਕ ਏ ਤਾਂ ਕਿ ਆਪਣੇ ਆਉਣ ਵਾਲੀ ਪੀੜ੍ਹੀਆਂ ਦੇ ਵਿੱਚ ਇਸਦਾ ਉਚਾਰਨ ਜ਼ਿਆਦਾ ਹੋਵੇ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਤਹਿਜ਼ੀਬ ਵਾਲੀ ਭਾਸ਼ਾ ਹੈ ਪੰਜਾਬੀ ਭਾਸ਼ਾ ਨੂੰ ਆਪਾਂ ਚ ਵੱਧ ਤੋਂ ਵੱਧ ਪ੍ਰਮੋਟ ਇਵੇਂ ਕਰ ਸਕਦੇ ਹਾਂ ਕਿ ਇਹਨੂੰ ਆਪਣੇ ਘਰਾਂ ਵਿੱਚ ਫੋਟੋਆਂ ਵਗੈਰਾ ਲਗਾ ਸਕਦੇ ਹਾਂ ਪੰਜਾਬੀ ਭਾਸ਼ਾ ਦੀ ਲਿਖਤ ਦੀਆਂ ਅਤੇ ਇਹ ਇੱਕ ਬਹੁਤ ਵਧੀਆ ਭਾਸ਼ਾ ਹੈ